ਸਾਡੇ ਪਿੰਡ ਵਿੱਚ ਡਾਂਸ ਬਹੁਤ ਮਹੱਤਵਪੂਰਨ ਹੈ ਸਾਂਝੇ ਸਮਿਆਂ 'ਤੇ ਖੁਸ਼ੀਆਂ ਵਿੱਚ ਮਨਾਉਣ ਦਾ ਢੰਗ ਹੈ ਮੌਕੇ 'ਤੇ ਲੋਕ ਇਕੱਠੇ ਹੋ ਕੇ ਗੀਤ ਗਾਉਂਦੇ ਹਨ ਅਤੇ ਨੱਚਦੇ ਹਨ ਜੋ ਸੰਸਕ੍ਰਿਤੀ ਨੂੰ ਜੀਵੰਤ ਰੱਖਦਾ ਹੈ ਕਿਸ ਨਾ ਸਖੀਆਂ ਅਤੇ ਭਾਈਚਾਰੇ ਦਾ ਭਾਵ ਬਣਦਾ ਹੈ ਅਤੇ ਦੁੱਖ ਸਾਂਝੇ ਕਰਨਾ ਆਸਾਨ ਹੁੰਦਾ ਹੈ ਮੈਂ ਵੀ ਇਸ ਵਿੱਚ ਭਾਗ ਲੈ ਕੇ ਮੌਜ ਮਾਣ ਕੇ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਸਾਡੇ ਪਿੰਡ ਵਿੱਚ ਨਾ ਸੇਨਾ ਜ਼ਿਆਦਾ ਜਰੂਰੀ ਹੈ ਕਿ ਜਦ ਵੀ ਕੋਈ ਖੁਸ਼ੀ ਦਾ ਮੌਕਾ ਹੋਵੇ ਤਾਂ ਲੋਕ ਖੁਸ਼ੀ ਵਿੱਚ ਡਾਂਸ ਕਰਨ ਲੱਗ ਜਾਂਦੇ ਹਨ ਅਤੇ ਲੋਕ ਇਸਦਾ ਭਰਪੂਰ ਮਾਤਰਾ ਵਿੱਚ ਆਨੰਦ ਮਾਣਦੇ ਹਨ ਅਤੇ ਇੱਕ ਪ੍ਰਕਾਰ ਦੇ ਨਾ ਅਲੱਗ ਹੀ ਖੁਸ਼ੀ ਉਹਨਾਂ ਦੇ ਚਿਹਰੇ ਵਿੱਚ ਦਿਖਾਈ ਦਿੰਦੀ ਹੈ ਡਾਂਸ ਕਰਨ ਨਾਲ ਅਤੇ ਉਹ ਲੋਕ ਇੱਕ ਦੂਜੇ ਨੂੰ ਚਾਅ ਚਾਅ ਵਿੱਚ ਹੀ ਡਾਂਸ ਕਰਨ ਲਾ ਦਿੰਦੇ ਹਨ ਅਤੇ ਇਹ ਸਾਰਾ ਕੁਛ ਸੱਥੀਆ ਭਾਈਚਾਰੇ ਦਾ ਭਾਵ ਬੰਦ ਹੈ ਅਤੇ ਦੁੱਖ ਸੁਖ ਸਾਂਝੇ ਕਰਨ ਆਸਾਨ ਹੁੰਦਾ ਹੈ ਮੈਂ ਵੀ ਇਸ ਵਿੱਚ ਭਾਗ ਲੈ ਕੇ ਮੌਜ ਮਾਣ ਕੇ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਡਾਂਸ ਸਾਡੇ ਪਿੰਡ ਵਿੱਚ ਸੱਭਿਆਚਾਰ ਅਤੇ ਸਮਾਜਿਕ ਜੀਵਨ ਦਾ ਇੱਕ ਅਟੁੱਟ ਅੰਗ ਹੈ ਇਹ ਵੱਖ ਵੱਖ ਮੌਕਿਆਂ 'ਤੇ ਜਿਵੇਂ ਤਿਉਹਾਰਾਂ ਵਿਆਹਾਂ ਅਤੇ ਸਮਾਜੀ ਸਮਾਗਮਾਂ ਵਿੱਚ ਕੀਤਾ ਜਾਂਦਾ ਹੈ ਲੋਕ ਡਾਂਸ ਨਾਲ ਆਪਣੇ ਅਨੁਭਵਾਂ ਨੂੰ ਵਿਅਕਤ ਕਰਦੇ ਹਨ ਅਤੇ ਮੌਕੇ ਦੀ ਖੁਸ਼ੀ ਨੂੰ ਸਾਂਝਾ ਕਰਦੇ ਹਨ ਡਾਂਸ ਦੇ ਰੂਪਾਂ ਵਿੱਚ ਲੋਕ ਨੱਚ ਭੰਗੜਾ ਗਿੱਧਾ ਅਤੇ ਹੋਰ ਰਵਾਇਤੀ ਅਤੇ ਨ੍ਰਿੱਤ ਸ਼ਾਮਿਲ ਹਨ ਜੋ ਹਰ ਪਿੰਡ ਆਪਣੇ ਵਿਸ਼ੇਸ਼ ਰੰਗ ਨੂੰ ਦਿਖਾਉਂਦੇ ਹਨ ਇਸ ਨਾਲ ਸਿੱਖਿਆ ਸੰਸਕ੍ਰਿਤੀ ਅਤੇ ਪੀੜ੍ਹੀਆਂ ਦੇ ਵਿਚਕਾਰ ਸੰਪਰਕ ਬਣਦਾ ਹੈ ਅਤੇ ਸਾਡੇ ਪਿੰਡ ਵਿੱਚ ਤਾਂ ਲੋਕ ਉਹ ਵੀ ਡਾਂਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਅਤੇ ਖੁਸ਼ੀ ਖੁਸ਼ੀ ਵਿੱਚ ਭੰਗੜਾ ਜਿਹਾ ਡਾਂਸ ਪਾਉਂਦੇ ਰਹਿੰਦੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਜਦ ਕੋਈ ਵੀ ਖੁਸ਼ੀ ਗਮੀ ਦਾ ਮੌਕਾ ਹੋਵੇ ਤਾਂ ਹਰ ਇੱਕ ਨੂੰ ਡਾਂਸ ਕਰ ਲੈਣਾ ਚਾਹੀਦਾ ਹੈ ਇਸ ਨਾਲ ਲੋਕਾਂ ਦੇ ਮਨਾਂ ਵਿੱਚ ਖੁਸ਼ੀ ਦਾ ਭਾਵ ਪੈਦਾ ਹੁੰਦਾ ਹੈ ਅਤੇ ਲੋਕ ਖੁਸ਼ ਰਹਿੰਦੇ ਆ ਅਤੇ ਜੀਵਨ ਦੇ ਗਮਾਂ ਤੋਂ ਦੂਰ ਰਹਿੰਦੇ ਹਨ ਅਤੇ ਇਸ ਤਰ੍ਹਾਂ ਡਾਂਸ ਸਿਰਫ ਮਨੋਰੰਜਨ ਦਾ ਹੀ ਨਹੀਂ ਸਗੋਂ ਸਾਂਝੇਦਾਰੀ ਅਤੇ ਪਿਆਰ ਦਾ ਇੱਕ ਬਹੁਤ ਪੂਰਨ ਤਰੀਕਾ ਹੈ ਜੋ ਲੋਕਾਂ ਨੂੰ ਡਾਂਸ ਦੇ ਰੂਪ ਵਿੱਚ ਜਿਵੇਂ ਕਿ ਨੱਚ ਭੰਗੜਾ ਗਿੱਧਾ ਅਤੇ ਹੋਰ ਰਵਾਇਤੀ ਨ੍ਰਿਤ ਸ਼ਾਮਿਲ ਹਨ ਜੋ ਹਰ ਪਿੰਡ ਦੇ ਆਪਣੇ ਵਿਸ਼ੇਸ ਰੰਗ ਨੂੰ ਦਿਖਾਉਂਦੇ ਹਨ ਅਤੇ ਇਹ ਸਿੱਖਿਆ ਪੀੜ੍ਹੀਆਂ ਦੇ ਵਿਚਕਾਰ ਸੰਪਰਕ ਬੰਦ ਹੈ ਇਸ ਲਈ ਮੈਂ ਕਹਿ ਸਕਦਾ ਕਿ ਸਾਡੇ ਪਿੰਡ ਵਿੱਚ ਤਾਂ ਡਾਂਸ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਲੋਕ ਇਸ ਦਾ ਬਹੁਤ ਹੀ ਜ਼ਿਆਦਾ ਆਨੰਦ ਮਾਣਦੇ ਹਨ